ਇਹ ਯਕੀਨੀ ਬਣਾਉਣ ਲਈ ਕਿ ਨਵੇਂ ਜੰਮੇ ਬੱਚਿਆਂ ਨੂੰ ਇੱਕ ਸਵੱਛ ਵਾਤਾਵਰਨ ਹੋਵੇ ਉਸ ਲਈ ਸਾਨੂੰ ਸਾਰਿਆਂ ਨੂੰ ਹੀ ਬਹੁਤ ਸਾਰੇ ਜਿਹੜੇ ਆ ਉਪਾਅ ਕਰਨੇ ਚਾਹੀਦੇ ਹਨ ਕਿਉਂਕਿ ਨਵੇਂ ਜੰਮੇ ਬੱਚੇ ਜਿਹੜੇ ਹੁੰਦੇ ਹਨ ਉਹ ਦੇਸ਼ ਦਾ ਅਤੇ ਆਉਣ ਵਾਲਾ ਭਵਿੱਖ ਹੁੰਦੇ ਹਨ ਇਸ ਲਈ ਉਹਨਾਂ ਬੱਚਿਆਂ ਦੀ ਸਾਂਭ ਸੰਭਾਲ ਉਹਨਾਂ ਦੀ ਸਰੀਰਿਕ ਸਿਹਤ ਦੇ ਉੱਤੇ ਜ਼ੋਰ ਜੇ ਅਸੀਂ ਸ਼ੁਰੂ ਤੋਂ ਹੀ ਦੇਵਾਂਗੇ ਤਾਂ ਉਹ ਬਹੁਤ ਹੀ ਅੱਛਾ ਅਤੇ ਲਾਭਦਾਇਕ ਹੋਵੇਗਾ ਅਤੇ ਨਵੇਂ ਜੰਮੇ ਬੱਚਿਆਂ ਲਈ ਸੁਰੱਖਿਆ ਸਵੱਛਤਾ ਨੂੰ ਬਣਾਈ ਰੱਖਣ ਵਾਸਤੇ ਪਹਿਲਾਂ ਅਸੀਂ ਆਪਣੇ ਘਰ ਤੋਂ ਸ਼ੁਰੂਆਤ ਕਰਾਂਗੇ ਕਿਉਂਕਿ ਨਵੇਂ ਜੰਮੇ ਬੱਚਿਆਂ ਨੂੰ ਪਹਿਲਾਂ ਅਸੀਂ ਆਪਣੇ ਘਰ ਤੋਂ ਹੀ ਅੱਗੇ ਸਿੱਖਿਆ ਦੇਵਾਂਗੇ ਤਾਂ ਹੀ ਅਸੀਂ ਬਾਹਰ ਜਾ ਕੇ ਹੋਰਾਂ ਨੂੰ ਅਸੀਂ ਸੁਰੱਖਿਅਤ ਕਰ ਸਕਾਂਗੇ ਨਵੇਂ ਜੰਮੇ ਬੱਚਿਆਂ ਦੀ ਖਾਤਿਰ ਅਸੀਂ ਪਹਿਲਾਂ ਆਪਣੇ ਘਰ ਦੇ ਆਲੇ ਦੁਆਲੇ ਦੀ ਬਾਊਂਡਰੀ ਅਤੇ ਆਲਾ ਦੁਆਲਾ ਸਾਫ਼ ਕਰਾਂਗੇ ਅਤੇ ਇਹ ਸੁਨਿਸ਼ਚਿਤ ਕਰਾਂਗੇ ਕਿ ਸਾਡੇ ਘਰ ਦਾ ਕੂੜਾ ਕਰਕਟ ਜਿਹੜਾ ਹੈ ਉਹ ਘਰ ਦੇ ਆਸ ਪਾਸ ਨਾ ਗਿਰੇ ਅਤੇ ਘਰ ਤੋਂ ਦੂਰ ਜਿੱਥੇ ਵੀ ਗਿਰੇ ਉੱਥੇ ਅੱਛੀ ਤਰ੍ਹਾਂ ਉਸ ਕੂੜੇ ਕਰਕਟ ਦੀ ਸਾਂਭ ਸੰਭਾਲ ਕੀਤੀ ਜਾ ਸਕੇ ਦੂਸਰਾ ਅਸੀਂ ਛੋਟੇ ਬੱਚਿਆਂ ਦੇ ਲਈ ਜਿਹੜਾ ਉਹਨਾਂ ਨੂੰ ਮੱਛਰ ਮੱਖੀ ਨਾ ਕੱਟੇ ਉਸ ਲਈ ਆਲੇ ਦੁਆਲੇ ਆਸ ਪਾਸ ਦੇ ਇਲਾਕੇ ਵਿੱਚ ਕੋਈ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਜਾ ਹੱਲ ਕਰਾਂਗੇ ਅਤੇ ਉੱਥੇ ਸਮੱ ਹਾ ਉਹ ਪਾਣੀ ਨੂੰ ਉਥੇ ਜਮਾ ਹੋਣ ਤੋਂ ਰੋਕਾਂਗੇ ਤੀਸਰਾ ਸਭ ਤੋਂ ਵੱਡਾ ਉਪਾਅ ਜਿਹੜਾ ਹੈ ਕਿ ਉਹਨਾਂ ਬੱਚਿਆਂ ਨੂੰ ਅਸੀਂ ਅੱਛੀ ਖਾਣ ਪਾਣ ਦੇਣ ਲਈ ਅੱਛੀਆਂ ਸਬਜ਼ੀਆਂ ਆਪਣੇ ਘਾ ਘਰ ਦੇ ਆਸ ਪਾਸ ਉਗਾਈਏ ਪਰ ਜਿਹੜੀਆਂ ਕੋਈ ਜੜ੍ਹੀ ਬੂਟੀਆਂ ਵੈਸੇ ਹੀ ਉੱਗ ਜਾਂਦੀਆਂ ਹਨ ਉਹਨਾਂ ਨੂੰ ਉੱਥੇ ਨਾ ਉੱਗਣ ਦੇਈਏ ਧੰਨਵਾਦ